ਹਾਂਜੀ ਮੌਜੂਦਾ ਸਮੇਂ ਵਿੱਚ ਜੀ ਜਿਹੜੇ ਵਿਗਿਆਪਨ ਹੈ ਲੋਕਾਂ ਤੱਕ ਪਹੁੰਚਾਉਣ ਦੇ ਬਹੁਤ ਵਧੀਆ ਹੁਣ ਸਾਧਨ ਹੈਗੇ ਨੇ ਜਿਹਦੇ ਵਿੱਚ ਫੇਸਬੁੱਕ ਹੈ ਯੂਟਿਊਬ ਹੈ ਹਾਂਜੀ ਇੰਟਰਨੈਟ ਰਾਹੀਂ ਮੀਡੀਆ ਹੋਰ ਚੈਨਲ ਵਗੈਰਾ ਬਹੁਤ ਨੇ ਅਤੇ ਇਹਨਾਂ ਰਾਹੀਂ ਅਸੀਂ ਆਪਣੇ ਇਸ਼ਤਿਹਾਰ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ ਮੈਂ ਇੱਕ ਆਪਣੇ ਪ੍ਰੋਡਕਟ ਬਾਰੇ ਇਹਨਾਂ ਨਾਲ ਫੇਸਬੁੱਕ ਰਾਹੀਂ ਇਸ਼ਤਿਹਾਰ ਦਿੱਤਾ ਸੀ ਜਿਹਦੇ ਬਾਰੇ ਮੈਨੂੰ ਬੜਾ ਭਰਮਾ ਹੁੰਗਾਰਾ ਮਿਲਿਆ ਅਤੇ ਬੜਾ ਇਹ ਪ੍ਰਭਾਵਸ਼ਾਲੀ ਰਿਹਾ ਜੀ